ਮੈਨੂੰ ਸਭ ਤੋਂ ਜ਼ਿਆਦਾ ਸਰਸੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਅਤੇ ਉਸ ਨਾਲ ਲੱਸੀ ਪਸੰਦ ਹੈ ਸਰਸੋਂ ਦਾ ਸਾਗ ਚੁੱਲ੍ਹੇ 'ਤੇ ਬਣਿਆ ਹੋਇਆ ਬਹੁਤ ਪਸੰਦ ਆਉਂਦਾ ਹੈ ਕਿਉਂਕਿ ਉਸ ਦਾ ਸਵਾਦ ਵੱਖਰਾ ਹੀ ਹੁੰਦਾ ਹੈ ਮੱਕੀ ਦੀ ਰੋਟੀ ਵੀ ਚੁੱਲ੍ਹੇ ਉੱਤੇ ਹੀ ਜ਼ਿਆਦਾ ਵਧੀਆ ਬਣਦੀ ਹੈ ਘਰ ਦੀ ਕੱਢੀ ਹੋਈ ਲੱਸੀ ਵੀ ਬੜੀ ਸਵਾਦ ਲੱਗਦੀ ਹੈ ਸ਼ਾ ਸਾਗ ਵਿੱਚ ਮੱਖਣ ਪਾ ਲਈਏ ਤਾਂ ਉਸ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ ਮੈਂ ਇਸ ਨੂੰ ਭਾਵੇਂ ਰੋਜ਼ ਖਾਈ ਜਾਵਾਂ ਮੈਂ ਇਸ ਤੋਂ ਮੇਰਾ ਮਨ ਨਹੀਂ ਭਰਦਾ ਅਤੇ ਹੋਰ ਸਵਾਦ ਬਣਾਉਣ ਲਈ ਮੈਂ ਇਸ ਵਿੱਚ ਪਿਆਜ਼ਾਂ ਦਾ ਤੜਕਾ ਲਗਾ ਕੇ ਖਾਂਦੀ ਹਾਂ ਜਿਸ ਨਾਲ਼ ਇਹ ਹੋਰ ਵੀ ਸਵਾਦ ਬਣ ਜਾਂਦਾ ਹੈ